ਹਾਂਜੀ ਪਹਿਲੇ ਦੇ ਮੁਕਾਬਲੇ ਨਾ ਔਰਤਾਂ ਦੀ ਭੂਮਿਕਾ ਬਹੁਤ ਹੀ ਬਦਲ ਚੁੱਕੀ ਏ ਪਹਿਲੇ ਲੋਕ ਡਰਦੇ ਸੀ ਕੁੜੀਆਂ ਨੂੰ ਦੂਰ ਭੇਜ ਕੇ ਹੁਣ ਤਾਂ ਕੁੜੀਆਂ ਬਹੁਤ ਦੂਰ ਦੂਰ ਤੱਕ ਜਾ ਕੇ ਪੜ੍ਹਦੀਆਂ ਹਨ ਅਤੇ ਆਪਣਾ ਕੰਮ ਵੀ ਕਰਦੀਆਂ ਹਨ ਹੁਣ ਕੋਈ ਡਰ ਨਹੀਂ ਹੈ ਹੈ ਨਾ ਕੋਈ ਰੁਕਾਵਟ ਨਹੀਂ ਔਰਤਾਂ ਦੇ ਉੱਪਰ ਕੁਛ ਵੀ ਨਹੀਂ ਭੂਮਿਕਾ ਹੁਣ ਤਾਂ ਏ ਔਰਤ ਹੀ ਹਰ ਜਗ੍ਹਾ ਆਪਣੀ ਜਗ੍ਹਾ ਆਦਮੀਆਂ ਦੀ ਲੈ ਕੇ ਬੈਠੀ ਹੋਈ ਹੈ ਬਹੁਤ ਵਧੀਆ ਹੋ ਰਿਹਾ ਪਹਿਲੇ ਪਹਿਲੇ ਤਾਂ ਲੋਕ ਬਹੁਤ ਡਰਦੇ ਸੀ ਪੜ੍ਹ